ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੇ ਬਰਨਾਲੇ ਕਲੱਬ 'ਚ ਭੇਜੋ ਜੀ ਬੱਚਿਆਂ ਨੂੰ ਆਪਾਂ ਸਾਰੀਆਂ ਐਕਟੀਵਿਟੀ ਕਰਵਾਉਂਦੇ ਹੈਗੇ ਕਸਰਤਾਂ ਯੋਗਾ ਰਨਿੰਗ ਵਗੈਰਾ ਖੇਡਾਂ ਸਿਖਾਉਂਦੇ ਹੈਗੇ ਡਾਂਸ ਵਗੈਰਾ ਸਾਰੀਆਂ ਆਪਾਂ ਕਰਵਾਉਂਦੇ ਹਾਂ ਜੀ ਤੁਸੀਂ ਬੱਚਿਆਂ ਨੂੰ ਇੱਥੇ ਸਾਡੇ ਕੋਲ ਭੇਜੋ ਅਸੀਂ ਵਧੀਆ ਸਿਖਲਾਈ ਦੇਵਾਂਗੇ ਉਹਨਾਂ ਨੂੰ ਹਾਂਜੀ ਬਿਲਕੁਲ ਤੁਸੀਂ ਉਹਨਾਂ ਨੂੰ ਕੋਈ ਇੱਦਾਂ ਦੀ ਖੇਡ ਵਿੱਚ ਜਿੱਦਾਂ ਹੋਕੀ ਹੋਕੀ ਦੀ ਖੇਡ ਕੁਛ ਵੀ ਪਲੇਅਰ ਦੀ ਇੱਦਾਂ ਦੀ ਚੀਜ਼ ਵਗੈਰਾ ਸਿਖਾ ਦਾਂਗੇ ਉਹਨਾਂ ਨੂੰ ਉਹਨਾਂ ਦੇ ਯੋਗ ਜਿਹੜੀ ਮਤਲਬ ਖੇਡ 'ਚ ਉਹਨਾਂ ਨੂੰ ਮਨਪਸੰਦ ਹੋਊ ਜਿਹੜੀ ਖੇਡ ਵੀ ਉਹੀ ਖੇਡ ਕਰਵਾ ਦਾਂਗੇ ਆਪਾਂ ਜੇ ਉਹਨਾਂ ਨੂੰ ਡਾਂਸ ਪਸੰਦ ਹੋਊ ਆਪਾਂ ਡਾਂਸ 'ਚ ਇੰਟਰਸਟ ਬਣਾ ਦਾਂਗੇ ਉਹਨਾਂ ਦਾ ਜੇ ਕੋਈ ਖੇਡ ਦਾ ਇੰਟਰਸਟ ਹੋਊ ਉਹ ਬਣਾ ਦਾਂਗੇ ਤੁਸੀਂ ਇੱਕ ਵਾਰ ਭੇਜ ਦਿਉ ਆਪਾਂ ਸਾਰੀਆਂ ਐਕਟੀਵਿਟੀ ਕਰਵਾ ਦਿੰਦੇ ਹਾਂ ਬੱਚਿਆਂ ਨੂੰ ਹਾਂਜੀ ਤੁਸੀਂ ਇੱਕ ਵਾਰ ਵਿਜਿਟ ਕਰਿਓ ਹਾਂਜੀ ਹਾਂਜੀ ਵਧੀਆ ਸੋਚਿਆ ਤੁਸੀਂ ਇੱਕ ਵਾਰੀ ਸਾਡੇ ਕਲੱਬ 'ਚ ਜ਼ਰੂਰ ਭੇਜੋ ਅਤੇ ਤੁਸੀਂ ਵੀ ਆਉ ਇੱਕ ਵਾਰ ਵਿਜਿਟ ਕਰੋ ਅਸੀਂ ਬੱਚਿਆਂ ਨੂੰ ਵਧੀਆ ਐਕਟੀਵਿਟੀ ਸਿਖਾਵਾਂਗੇ ਤਾਂ ਕਿ ਉਹ ਅੱਗੇ ਆਪਣੀ ਟਾਈਮਿੰਗ ਜੀ ਮਤਲਬ ਕਦੋਂ ਵੀ ਭੇਜ ਸਕਦੇ ਹੋ ਤੁਸੀਂ ਸਕੂਲ ਤੋਂ ਬਾਅਦ ਬੱਚਿਆਂ ਨੂੰ ਵੈਸੇ ਸ਼ਾਮ ਦੇ ਪੰਜ ਵਜੇ ਤੱਕ ਹੁੰਦੀ ਹੈ ਆਪਣੀ ਟਾਈਮਿੰਗ ਸੁਬਹ ਦਸ ਵਜੇ ਤੋਂ ਤੁਸੀਂ ਬੱਚਿਆਂ ਨੂੰ ਇਹ ਟਾਈਮ ਵਿੱਚ ਕਦੋਂ ਵੀ ਭੇਜ ਸਕਦੇ ਹੋ ਆਪਾਂ ਸਾਰੀਆਂ ਐਕਟੀਵਿਟੀ ਕਰਵਾ ਦਾਂਗੇ ਉਹਨਾਂ ਨੂੰ ਸਾਰੇ ਕਾਸੇ ਦੀ ਰਹਿਸਲ ਵਧੀਆ ਕਰਵਾਉਂਦੇ ਨੇ ਆਪਣੇ ਟੀਚਰ ਸਾਰੇ ਵਧੀਆ ਨੇ ਆਪਾਂ ਵਧੀਆ ਨੌਲਜ ਦਵਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਓਕੇ ਜੀ ਥੈਂਕ ਯੂ